ਹਾਂਜੀ ਹਾਂਜੀ ਹਾਂਜੀ ਬੋਲੋ ਹਾਂਜੀ ਹਾਂਜੀ ਹਾਂਜੀ ਦੱਸੋ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਨਹੀਂ ਤੁਸੀਂ ਕੀ ਕਹਿੰਦੇ ਨੇ ਟੂਰਿਸਟ ਤਾਂ ਹੈਗੇ ਹੋ ਕਿ ਇੱਥੇ ਤੁਸੀਂ ਰਹਿੰਦੇ ਹੈਗੇ ਹੋ ਵੈਸੇ ਅੱਛਾ ਤੁਸੀਂ ਘੁੰਮਣ ਆਏ ਹੋ ਅੱਛਾ ਤੁਸੀਂ ਇਥੋਂ ਇੱਕ ਟਰੇਨ ਜਾਂਦੀ ਹੈਗੀ ਆ ਅੰਮ੍ਰਿਤਸਰ ਵੱਲ ਦੀ ਲੁਧਿਆਣਾ ਤੋਂ ਅੰਮ੍ਰਿਤਸਰ ਜਾਂਦੀ ਹੈ ਇੰਟਰਸਿਟੀ ਐਕਸਪ੍ਰੈਸ ਤੁਸੀਂ ਉਹਦੇ ਵਿੱਚ ਬੈਠ ਕੇ ਉੱਧਰ ਜਾ ਸਕਦੇ ਹੋ ਅੰਮ੍ਰਿਤਸਰ ਉਤੇ ਤੁਸੀਂ ਗੋਲਡਨ ਟੈਂਪਲ ਵਿਜ਼ਿਟ ਕਰ ਸਕਦੇ ਹੈਗੇ ਹੋ ਅਤੇ ਇੱਕ ਤਾਂ ਟਰੇਨ ਉਹ ਹੈਗੀ ਹੈ ਅਤੇ ਇੱਕ ਤੁਸੀਂ ਉੱਧਰ ਚੰਡੀਗੜ੍ਹ ਵੱਲ ਨੂੰ ਜਾ ਸਕਦੇ ਹੋ ਜੇ ਤੁਸੀਂ ਜਾਣਾ ਚਾਹੁੰਦੇ ਹੋ ਅਤੇ ਹਾਂਜੀ ਹਾਂਜੀ ਲੁਧਿਆਣੇ ਤੋਂ ਮਿਲ ਜੇਗੀ ਅਤੇ ਇੱਧਰ ਤੁਸੀਂ ਹਿਮਾਚਲ ਵਾਲੀ ਸਾਈਡ 'ਤੇ ਵੀ ਜਾ ਸਕਦੇ ਹੋ ਜੇ ਤੁਸੀਂ ਪਹਾੜਾਂ ਵਾਲੀ ਸਾਈਡ ਨਹੀਂ ਤੁਸੀਂ ਜਾਣਾ ਕਿੱਥੇ ਚਾਹੁੰਦੇ ਹੋ ਪਹਿਲੇ ਉਹ ਸਾਨੂੰ ਦੱਸੋ ਨਾ ਫਿਰ ਮੈਂ ਉਸ ਹਿਸਾਬ ਨਾਲ ਤੁਹਾਨੂੰ ਟਰੇਨ ਦੱਸਾਂ ਅੱਛਾ ਫਿਰ ਇੱਥੋਂ ਟਰੇਨ ਜਾਂਦੀ ਹੈ ਉਹ ਆਪਣਾ ਕੀ ਕਹਿੰਦੇ ਨੇ ਸਵੇਰੇ ਜਾਂਦੀ ਹੈ ਸਾਢੇ ਸੱਤ ਅੱਠ ਵਜੇ ਇੱਥੋਂ ਢਾਈ ਘੰਟੇ ਦਾ ਸਫ਼ਰ ਹੁੰਦਾ ਲੁਧਿਆਣਾ ਤੋਂ ਅੰਮ੍ਰਿਤਸਰ ਦਾ ਵਿੱਚ ਓ ਹਿਮਾਚਲ ਵੱਲ ਜਿਹੜਾ ਹੈਗਾ ਉਹ ਵੱਧ ਜਾਂਦਾ ਹੈਗਾ ਇੱਥੋਂ ਤੁਹਾਨੂੰ ਕੀ ਕਹਿੰਦੇ ਨੇ ਚੰਡੀਗੜ੍ਹ ਤੱਕ ਦੀ ਟਰੇਨ ਲੈਣੀ ਪਏਗੀ ਉਸ ਤੋਂ ਬਾਅਦ ਅੱਗੇ ਤੁਹਾਨੂੰ ਕਾਲਕਾ ਤੋਂ ਟੋਇ ਟਰੇਨ ਮਿਲੂਗੀ ਹਿਮਾਚਲ ਵਾਲੀ ਸਾਈਡ 'ਤੇ ਉਹ ਤੁਹਾਡਾ ਮਤਲਬ ਤੁਸੀਂ ਮੰਨ ਕੇ ਚੱਲੋ ਇੱਥੋਂ ਤੁਹਾਡਾ ਚੰਡੀਗੜ੍ਹ ਦਾ ਦੋ ਤਿੰਨ ਦੋ ਢਾਈ ਘੰਟੇ ਦਾ ਰਸਤਾ ਹੋਵੇਗਾ ਫਿਰ ਉਥੋਂ ਅੱਗੇ ਤੁਹਾਨੂੰ ਕਾਲਕਾ ਵਾਸਤੇ ਟਰੇਨ ਲੈਣੀ ਪਏਗੀ ਤੁਹਾਨੂੰ ਤਿੰਨ ਟਰੇਨਾਂ ਚੇਂਜ ਕਰਨੀਆਂ ਪੈਣਗੀਆਂ ਚੰਡੀਗੜ੍ਹ ਤੋਂ ਕਾਲਕਾ ਇੱਕ ਟ੍ਰੇਨ ਹੋਵੇਗੀ ਉਹ ਅੱਗੇ ਪੈਂਤੀ ਚਾਲੀ ਮਿੰਟ ਦਾ ਰਸਤਾ ਹੋਵੇਗਾ ਫਿਰ ਜੇ ਟੋਇ ਟ੍ਰੇਨ ਤੁਸੀਂ ਲਓਗੇ ਉਹ ਪੰਜ ਘੰਟੇ ਦਾ ਫਰ ਸਫ਼ਰ ਹੋਵੇਗਾ ਅੱਗੇ ਉੱਪਰ ਜਾਣ ਵਾਸਤੇ ਹਾਂਜੀ ਹਾਂਜੀ ਹਾਂ ਲੁਧਿਆਣੇ ਤੋਂ ਮਿਲ ਜੇਗੀ ਜਾਂ ਬੜੀਆਂ ਟ੍ਰੇਨਾਂ ਜਾਂਦੀਆਂ ਹੈਗੀਆਂ ਅੰਮ੍ਰਿਤਸਰ ਨੂੰ ਤੁਸੀਂ ਸਵੇਰੇ ਸਵੇਰ ਦੀ ਟਰੇਨ ਜਿਹੜੀ ਇੱਕ ਜਾਂਦੀ ਹੈ ਇੰਟਰਸਿਟੀ ਜਾਂਦੀ ਹੈ ਉਹ ਜਾਂਦੀ ਹੈਗੀ ਆ ਸਾਡੇ ਸਵੇਰੇ ਅ ਨੌਂ ਸਾਢੇ ਨੌਂ ਵਜੇ ਜਾਂਦੀ ਹੈ ਉੱਥੇ ਗਿਆਰਾਂ ਕੁ ਵਜੇ ਪਹੁੰਚਾ ਦਿੰਦੀ ਆ ਹਾਂਜੀ ਨਹੀਂ ਨਹੀਂ ਇਹ ਅ ਦੋ ਨੰਬਰ ਪਲੈਟਫੋਰਮ 'ਤੇ ਆਉਂਦੀ ਹੈ ਇਹ ਗੱਡੀ ਦਾ ਨੰਬਰ ਹੈਗਾ ਹੈ ਦੋ ਇੱਕ ਦੋ ਚਾਰ ਇੱਕ ਇੱਕ ਕਰਕੇ ਗੱਡੀ ਦਾ ਨਾਮ ਅ ਨੰਬਰ ਹੈ ਨੰਬਰ ਹੈਗਾ ਅਤੇ ਗੱਡੀ ਦਾ ਨੰਬਰ ਇੰਟਰਸਿਟੀ ਹਾਂਜੀ ਹਾਂਜੀ ਹਾਂਜੀ

ਇਹਦਾ ਫਿਰ ਹੋਵੇਗਾ ਅ ਜੇ ਤੁਸੀਂ ਜਰਨਲ ਦੇ ਵਿੱਚ ਜਾਣਾ ਚਾਹੋਂਗੇ ਤਾਂ ਸੱਠ ਰੁਪਏ ਹੈਗਾ ਅਤੇ ਤੁਸੀਂ ਰਿਜ਼ਰਵੇਸ਼ਨ ਕਰਾਓਗੇ ਤਾਂ ਉਹ ਇੱਕ ਸੌ ਸੱਠ ਜਾਂ ਦਸ ਰੁਪਏ ਦੀ ਹੋਵੇਗੀ ਜੇ ਤੁਸੀਂ ਹਾਂਜੀ ਜੇ ਤੁਸੀਂ ਇੱਕ ਦਿਨ ਪਹਿਲਾਂ ਟਿਕਟ ਬੁੱਕ ਕਰਾਓਗੇ ਤਾਂ ਮਿਲ ਜੇਗੀ ਖੜ੍ਹੇ ਪੈਰ ਨਹੀਂ ਮਿਲਦੀ ਹੈਗੀ ਖੜ੍ਹੇ ਪੈਰ ਤੁਹਾਨੂੰ ਫਿਰ ਉਹ ਕੀ ਕਹਿੰਦੇ ਨੇ ਆਪਣਾ ਜਰਨਲ ਦੀ ਟਿਕਟ ਲੈ ਕੇ ਜਾਣਾ ਪਵੇਗਾ ਜੇ ਤੁਸੀਂ ਖੜ੍ਹੇ ਪੈਰ ਟਿਕਟ ਬੁੱਕ ਕਰਾਓਗੇ ਫਿਰ

ਹਾਂਜੀ ਹਾਂਜੀ ਚਲੋ ਬਾਕੀਆਂ ਨੂੰ ਵੀ ਆ ਲੈਣ ਦਿਓ ਤੁਸੀਂ ਸਾਰੀ ਗੱਲਾਂ ਤੁਸੀਂ ਕਰ ਲੈਣੀਆਂ ਹੁਣ ਉਹ ਪਿੱਛੇ ਇੰਨੇ ਜਾਣੇ ਖੜ੍ਹੇ ਨੇ ਤੁਸੀਂ ਫਿਰ ਹਾਂਜੀ ਹਾਂਜੀ ਉਹ ਤਾਂ ਹੈ ਠੀਕ ਹੈ ਜੀ